ਹੈਲੋ ਹਾਂਜੀ ਹਾਂਜੀ ਹਾਂਜੀ ਨਮਸਤੇ ਜੀ ਨਮਸਤੇ ਜੀ ਹਾਂਜੀ ਠੀਕ ਹੋ ਹਾਂਜੀ ਹਾਂ ਹਾਂਜੀ ਹਾਂਜੀ ਬਹੁਤ ਵਧੀਆ ਸ਼ਹਿਰ 'ਚ ਤਾਂ ਬਹੁਤ ਹੀ ਵਧੀਆ ਪਿੰਡਾਂ 'ਚ ਤਾਂ ਬਹੁਤ ਹੀ ਔਖਾ ਸੀਗਾ ਬੱਚਿਆਂ ਨੂੰ ਹਾਂ ਹਾਂਜੀ ਹਾਂਜੀ ਹਾਂ ਬੱਚੇ ਬੱਚਿਆਂ ਦਾ ਇੱਥੇ ਬਹੁਤ ਸੌਖਾ ਕਿੰਨਾ ਹਾਂ ਸਕੂਲ ਦੇ ਨੇੜੇ ਹਾਂਜੀ ਹਾਂਜੀ ਹਾਂਜੀ ਉੱਥੇ ਪਿੰਡਾਂ 'ਚ ਥੋੜ੍ਹਾ ਜਿਹਾ ਬੱਚਿਆਂ ਦਾ ਵੀ ਮੁਸ਼ਕਲ ਸੀਗਾ ਹੈ ਨਾ ਉੱਥੇ ਕੋਈ ਦਵਾਈ ਲੈਣੀ ਕੋਈ ਸਕੂਲ ਬੱਚਿਆਂ ਨੂੰ ਭੇਜਣਾ ਟਿਊਸ਼ਨ ਜਾਣਾ ਤਾਂ ਹੀ ਮੁਸ਼ਕਿਲ ਸੀ ਅਤੇ ਸ਼ਹਿਰ ਵਿੱਚ ਆ ਕੇ ਤਾਂ ਹਾਂ ਬਹੁਤ ਵਧੀਆ ਸ਼ਹਿਰਾਂ 'ਚ ਤਾਂ ਹੁਣ ਕੋਈ ਵੀ ਹਾਂ ਉੱਥੇ ਇੱਥੇ ਡੋਕਟਰ ਨੇ ਸਾਰੇ ਟਾਈਮ ਨਾਲ ਬੱਚਿਆਂ ਦੀ ਕੋਈ ਦਿੱਕਤ ਨਹੀਂ ਹੈਗੀ ਵੈਨ ਵੀ ਆ ਜਾਂਦੀ ਹੈ ਸਕੂਲ ਤੋਂ ਵੈਨ 'ਤੇ ਚੱਲਦਾ ਲੋਕਲ ਦਸ ਮਿੰਟ ਹੀ ਲੱਗਦੇ ਆ ਬੱਚੇ ਦਸ ਮਿੰਟ ਪਹਿਲਾਂ ਹੀ ਪਹੁੰਚ ਜਾਂਦੇ ਆ ਹਾਂ ਪਿੰਡੋਂ ਆਉਣਾ ਤਾਂ ਮੁਸ਼ਕਿਲ ਹੀ ਸੀਗਾ ਪਿੰਡੋਂ ਆਉਣਾ ਤਾਂ ਹਾਂ ਘੰਟਾ ਚਾਹੀਦਾ ਹਾਂ ਸੁਬਹਾ ਹਾਂ ਜਲਦੀ ਸਰਦੀ ਦੇ ਮੌਸਮ 'ਚ ਤਾਂ ਬਹੁਤ ਹੀ ਮੁਸ਼ਕਿਲ ਹੁੰਦੀ ਸੀ ਸਰਦੀ ਗਰਮੀ 'ਚ ਤਾਂ ਫਿਰ ਵੀ ਨਹੀਂ ਇੰਨਾ ਸਰਦੀ 'ਚ ਤਾਂ ਬਹੁਤ ਹੀ ਮੁਸ਼ਕਿਲ ਬੱਚਿਆਂ ਨੂੰ ਹੁੰਦੀ ਸੀ ਹੋਰ ਮਿਲ ਜਾਂਦਾ ਹਾਂ ਹੋਰ ਠੀਕ ਹੋ ਹੁਣ ਤਾਂ ਇੱਥੇ ਆ ਕੇ ਤਾਂ ਬਸ ਦੋ ਘੰਟੇ 'ਚ ਹੀ ਸਾਰਾ ਕੰਮ ਹਾਂਜੀ ਬੱਚੇ ਸਕੂਲ ਚਲੇ ਜਾਂਦੇ ਆ ਫਿਰ ਬਾਜ਼ਾਰ ਜਾਓ ਘੰਟੇ 'ਚ ਸਾਰਾ ਕੰਮ ਵੀ ਨਿਪਟਾ ਕੇ ਆ ਜਾਈਦਾ ਹਾਂ ਹਾਂ ਨੇੜੇ ਹੀ ਡਾਕਟਰ ਮਿਲ ਜਾਂਦੇ ਹੈ ਨੇੜੇ ਨੇੜੇ ਕੋਈ ਦੁੱਖ ਸੁੱਖ ਆ ਜਾਏ ਬੱਚਿਆਂ ਨੂੰ ਕੋਈ ਸਰਦੀ ਮੌਸਮ ਹੈ ਕੋਈ ਆ ਜਾਏ ਪਰ ਨੇੜੇ ਜਿਹੇ ਡਾਕਟਰ ਮਿਲ ਜਾਂਦੇ ਆ ਹੋਸਪਿਟਲ ਵੀ ਨੇੜੇ ਆ ਹਾਂ ਹਾਂਜੀ ਸ਼ਹਿਰ ਦੇ ਤਾਂ ਸੁੱਖ ਬਹੁਤ ਹਾਂਜੀ ਹਾਂਜੀ ਹਾਂਜੀ ਹਾਂ ਹਾਂ ਮੇਨ ਹਾਂ ਸੌਖਾ ਹੋ ਗਿਆ ਐਤਵਾਰ ਛੁੱਟੀ ਹੁੰਦੀ ਹੈ ਬੱਚਿਆਂ ਨੂੰ ਹਾਂ ਘੁੰਮਾ ਸਕਾਂ ਹਾਂ ਸ਼ਹਿਰਾਂ ਵਰਗੀ ਤਾਂ ਨਹੀਂ ਹਾਂ ਪਿੰਡਾਂ 'ਚ ਹੋ ਗਈ ਪਰ ਨਾ ਬੱਚਾ ਥੋੜ੍ਹਾ ਜਿਹਾ ਹੁਣ ਪੜ੍ਹਾਈਆਂ ਦਾ ਫਰਕ ਹੈ ਨਾ ਥੋੜ੍ਹਾ ਜਿਹਾ ਕਹਿੰਦੇ ਸ਼ਹਿਰ ਵਾਲੇ ਸਕੂਲ 'ਚ ਹੀ ਜਾਣਾ ਉੱਥੇ ਫਿਰ ਲਾਗੇ ਸ਼ਹਿਰ ਵਾਲੇ ਸਕੂਲ 'ਚ ਹੀ ਜਾਣਾ ਹਾਂ ਗੌਰਮੈਂਟ ਸਕੂਲ ਹੀ ਹੈ ਹਾਂ ਹੋਰ ਨਹੀਂ ਤਾਂ ਪੜ੍ਹਾਈ ਉੱਥੇ ਵੀ ਹੁਣ ਅੱਛੀ ਹੋ ਗਈ ਪੜ੍ਹਾਈ ਤਾਂ ਨਹੀਂ ਮਾੜੀ ਪਰ ਬੱਚਿਆਂ ਦੀ ਦਿੱਕਤ ਆਉਂਦੀ ਸੀ ਵੱਡੀਆਂ ਕਲਾਸਾਂ 'ਚ ਵੱਡੀਆਂ ਕਲਾਸਾਂ ਹੋ ਜਾਣ ਨਾ ਬੱਚਿਆਂ ਦੀਆਂ ਬੱਚਿਆ ਦੀਆਂ ਹਾਂ ਟਿਊਸ਼ਨ ਵਾਲੀ ਤਾਂ ਟਿਊਸ਼ਨ ਦੀ ਵਧੀਆ ਕਲਾਸਾਂ ਦੀ ਟਿਊਸ਼ ਹਾਂ ਤਾਂ ਵੀ ਸ਼ਹਿਰ ਆਉਣਾ ਪੈਂਦਾ ਸੀ ਹਾਂ ਹਾਂਜੀ ਹਾਂਜੀ ਹਾਂਜੀ ਹਾਂ